ਹੈਲੋ ਹਾਂਜੀ ਧਾਲੀਵਾਲ ਟਰਾਂਸਪੋਰਟ ਤੋਂ ਬੋਲਦੇ ਹੈ ਜੀ ਮੈਂ ਨਾ ਆਪਣਾ ਜਿੱਦਾਂ ਟੂਰਿਸਟ ਵੀਜ਼ਾ ਆਪਣਾ ਟ੍ਰੈਵਲਿੰਗ ਵੀਜ਼ੇ 'ਤੇ ਜਾਣਾ ਹੈ ਮਨਾਲੀ ਸਾਈਡ ਉਹਦੇ ਬਾਰੇ ਪਤਾ ਕਰਨਾ ਸੀ ਮਤਲਬ ਜਿੱਦਾਂ ਤੁਸੀਂ ਆਪਣੀ ਅ ਵਹੀਕਲ ਗੱਡੀ ਆਪ ਦੇ ਸਕਦੇ ਹੈ ਮਤਲਬ ਜਾਂ ਕਿੱਦਾਂ ਉੱਥੇ ਮਤਲਬ ਰਹਿਣ ਸਹਿਣ ਦਾ ਮਤਲਬ ਹੋਟਲ ਦਾ ਕੀ ਅਰੇਂਜਮੈਂਟ ਹੈ ਤੁਹਾਡਾ ਅੱਗੇ ਉਹਦੇ ਬਾਰੇ ਪਤਾ ਕਰਨਾ ਸੀ ਜੀ ਅੱਛਾ ਜੀ ਵਾ ਗੱਡੀ ਆ ਮਤਲਬ ਗੱਡੀ ਦਾ ਤੁਹਾਡਾ ਮਤਲਬ ਅੱਗੇ ਦਾ ਨਹੀਂ ਹੈ ਜੀ ਹੈ ਇੱਕ ਤਾਂ ਆਵਾਜ਼ ਕੱਟ ਰਹੀ ਤੁਹਾਡੀ ਹਾਂ ਹਾਂਜੀ ਹਾਂਜੀ ਹੈਲੋ ਆਵਾਜ਼ ਕੱਟ ਰਹੀ ਮੈਂ ਕਿਹਾ ਤੁਹਾਡੀ

ਅੱਛਾ ਅੱਛੇ ਅੱਛੇ ਅੱਛੇ ਅੱਛੇ ਮਤਲਬ ਤੁਹਾਡਾ ਕੰਪਨੀ ਦੇ ਥਰੂ ਮਤਲਬ ਜਿੱਦਾਂ ਤੁਹਾਡੀ ਟਰੈਵਲ ਏਜੰਸੀ ਦੇ ਵੱਲੋਂ ਕੋਈ ਉਹ ਨਹੀਂ ਹੈ ਹੈ ਅੱਛਾ ਅੱਛਾ ਜੀ ਠੀਕ ਠੀਕ ਮਤਲਬ ਕਿੰਨੇ ਕੁ ਦਿਨ ਪਹਿਲਾਂ ਤੁਹਾਨੂੰ ਦੱਸਣਾ ਪਏਗਾ ਫਿਰ ਇਹ ਅੱਛਾ ਅੱਛ ਅੱਛਾ ਅੱਛਾ ਜੀ ਗੱਡੀ ਦਾ ਵੀ ਫਿਰ ਮਤਲਬ ਚਾਰ ਪੰਜ ਚਾਰ ਪੰਜ ਹੈ ਫੈਮਲੀ ਮੈਂਬਰ ਉਹਦੇ ਬ ਬਸ ਇੰਨੇ ਹੀ ਜ਼ਿਆਦਾ ਵੱਡੀ ਫੈਮਲੀ ਵੀ ਨਹੀਂ ਹੈ ਉਹਦੇ ਲਈ ਬਸ ਇੰਨਾ ਕੁ ਹੈ ਠੀਕ ਨਹੀਂ ਹਾਂਜੀ ਹਾਂਜੀ ਚੱਲੋ ਠੀਕ ਹੈਂ ਬਾਈ ਹੈ ਓਕੇ ਧੰਨਵਾਦ ਜੀ